ਹਾਂ ਜਿਹੜਾ ਅਸੀਂ ਕਣਕ ਝੌਨਾ ਲਗਾਉਂਦੇ ਹਾਂ ਉਹਦੀ ਫਸਲ ਸਾਨੂੰ ਚੰਗੀ ਮਿਲਦੀ ਹੈ ਬਹ ਬੜਾ ਮੁਨਾਫਾ ਹੋ ਜਾਂਦਾ ਹੈ ਚੱਲੋ ਅਸੀਂ ਸਾਲ ਭਰ ਭਰ ਆਰਾਮ ਨਾਲ ਕੱਢ ਲੈਂਦੇ ਹਾਂ ਦੂਸਰੀ ਫਸਲ ਫਿਰ ਤਿਆਰ ਹੋ ਜਾਂਦੀ ਹੈ ਦੂਸਰੀ ਫਸਲ ਫਿਰ ਤਿਆਰ ਹੋ ਜਾਂਦੀ ਹੈ ਸਭ ਸਾਡੇ ਬੱਚੇ ਬੜੇ ਖੁਸ਼ ਹੋਏ ਹੁੰਦੇ ਨੇ ਅਸੀਂ ਚੰਗਾ ਹੀ ਬੀਜ਼ ਪਾਉਂਦੇ ਹਾਂ ਚੰਗੀ ਫਸਲ ਤਿਆਰ ਹੁੰਦੀ ਹੈ ਬਹੁਤ ਵਧੀਆ ਕੰਮ ਚੱਲੇ ਦਾ ਬਸ ਹਾਂ ਬਹੁਤ ਬਹੁਤ ਫਸਲ ਚੰਗੀ ਹੋ ਜਾਏ ਤਾਂ ਫ ਪੈਸਾ ਵੀ ਚੰਗਾ ਮਿਲ ਜਾਂਦਾ ਫਸਲ ਨਹੀਂ ਚੰਗੀ ਹੋਈ ਤਾਂ ਪੈਸਾ ਕਿ ਚੰਗਾ ਨਹੀਂ ਮਿਲਦਾ ਹਾਂ ਕਣਕ ਕਣਕ ਬਹੁਤ ਵਧੀਆ ਹੋ ਜਾਂਦੀ ਹੈ ਝੋਨਾ ਬਹੁਤ ਵਧੀਆ ਹੋ ਜਾਂਦਾ ਹੈ ਅਸੀਂ ਖੁਸ਼ ਆਪਣੇ ਘਰ 'ਚ ਠੀਕ ਚੰਗਾ ਪ੍ਰੋਫਿਟ ਹੋ ਜਾਂਦਾ ਸਾਨੂੰ ਕੋਈ ਫਿਕਰ ਨਹੀਂ ਫਸਲ ਦੇ ਬਾਰੇ ਸਾਨੂੰ ਕੋਈ ਫਿਕਰ ਨਹੀਂ ਹੈ